ਕਈ ਵਾਰ ਕੁਛ ਦਿਨ ਇੱਦਾਂ ਦੇ ਹੁੰਦੇ ਹਨ ਜਦੋਂ ਸਾਡਾ ਕੁਝ ਵੀ ਬਣਾਉਣ ਭਾਵ ਚਿੱਤਰਕਾਰੀ ਕਰਨ ਦਾ ਦਿਲ ਬਿਲਕੁਲ ਨਹੀਂ ਕਰਦਾ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਾਡੀ ਤਬੀਅਤ ਨਹੀਂ ਠੀਕ ਹੁੰਦੀ ਜਾਂ ਸਾਡਾ ਸਿਰ ਦਰਦ ਕਰਦਾ ਹੈ ਜਾਂ ਸਾਡੇ ਕੋਲ ਘਰ ਦੇ ਕੰਮ ਜ਼ਿਆਦਾ ਹੋ ਜਾਂਦੇ ਹਨ ਜਾਂ ਫਿਰ ਸਾਨੂੰ ਸਕੂਲ ਜਾਂ ਕਾਲਜ ਵਿੱਚੋਂ ਜ਼ਿਆਦਾ ਕੰਮ ਕਰਨ ਲਈ ਮਿਲਿਆ ਹੁੰਦਾ ਹੈ ਜਾਂ ਕਿ ਅਗਲੇ ਦਿਨ ਟੈਸਟ ਹੁੰਦਾ ਹੈ ਤਾਂ ਅਸੀਂ ਉਸ ਦੀ ਵੀ ਤਿਆਰੀ ਕਰਨੀ ਹੁੰਦੀ ਹੈ ਜਿਸ ਕਰਕੇ ਸਾਡਾ ਮਾਣ ਮਨ ਕਹਿ ਲਓ ਕਿ ਨਹੀਂ ਕਰਦਾ ਹੈਗਾ ਜਾਂ ਫਿਰ ਸਾਡੇ ਕੋਲੇ ਟਾਈਮ ਹੀ ਓਨਾਂ ਕੁ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਨਹੀਂ ਬਣਾ ਸਕਦੇ ਪਰ ਜੇਕਰ ਅਸੀਂ ਸਾਰਾ ਕੁਝ ਇੱਕ ਟਾਈਮ ਟੇਬਲ ਦੇ ਅਕੋਰਡਿੰਗ ਦੇਖੀਏ ਤਾਂ ਬਣਾ ਕੇ ਕਿ ਅਸੀਂ ਇੰਨੇ ਟਾਈਮ ਵਿੱਚ ਕੰਮ ਕਰਨਾ ਹੈ ਅਤੇ ਇੰਨਾ ਟਾਈਮ ਮੈਂ ਆਪਣੀ ਚਿੱਤਰਕਾਰੀ ਲਈ ਰੱਖਣਾ ਹੈ ਇਸ ਤਰ੍ਹਾਂ ਅਸੀਂ ਆਸੇ ਪਾਸਿਓਂ ਜਾਂ ਸਾਡੇ ਦਿਮਾਗ ਵਿੱਚ ਕੋਈ ਇਹੋ ਜਿਹਾ ਥੋਟ ਆ ਜਾਂਦਾ ਜੋ ਸਾਨੂੰ ਡਰੋਅ ਕਰਨ ਲਈ ਮੋਟੀਵੇਟ ਕਰਦਾ ਹੈਗਾ ਅਸੀਂ ਹੋਰ ਕੰਮਾਂ ਕੰਮਾਂ ਦਾ ਵੀ ਪ੍ਰਬੰਧਨ ਕਰਨਾ ਹੁੰਦਾ ਅਤੇ ਚਿੱਤਰਕਾਰੀ ਦਾ ਵੀ ਪ੍ਰਬੰਧਨ ਕਰਨਾ ਹੁੰਦਾ ਹੈ ਕਿ ਅਸੀਂ ਇਸ ਨੂੰ ਡਰੋਅ ਕਿਸ ਤਰ੍ਹਾਂ ਕਰਨਾ ਹੈ ਇਹ ਕਿੰਨੇ ਟਾਈਮ ਵਿੱਚ ਡਰੋਅ ਹੋ ਜਾਵੇਗਾ ਜਾਂ ਫਿਰ ਅਸੀਂ ਇਹ ਕੰਮ ਕਰਨਾ ਹੈ ਕੋਈ ਘਰ ਦਾ ਜੋ ਸਕੂਲ ਦਾ ਇਹ ਇੰਨੇ ਟਾਈਮ ਵਿੱਚ ਖਤਮ ਹੋ ਜਾਵੇਗਾ ਤਾਂ ਮੈਂ ਆਪਣੀ ਅੱਗੇ ਚਿੱਤਰਕਾਰੀ ਸਟਾਰਟ ਕਰ ਸਕਦਾ ਹਾਂ